ਪੰਜਾਬ ਦੇ ਵਿੱਚ ਜ਼ਿਆਦਾਤਰ ਕਬੱਡੀ ਅਤੇ ਕੁਸ਼ਤੀ ਦੇ ਮੇਲੇ ਵੱਖ ਵੱਖ ਜਗ੍ਹਾ 'ਤੇ ਹਰ ਸਾਲ ਲੱਗਦੇ ਹਨ ਇਹਨਾਂ ਨੂੰ ਔਰਗਨਾਇਜ ਕਰਨ ਵਾਲੀਆਂ ਸੰਸਥਾਵਾਂ ਵੀ ਹਰ ਜ਼ਿਲ੍ਹੇ ਵਿੱਚ ਹਨ ਔਰ ਇਹਨਾਂ ਜ਼ਿਲ੍ਹਿਆਂ ਦਾ ਜੋ ਵੀ ਫੰਡ ਦਾ ਅਰੇਂਜਮੈਂਟ ਕਰਨ ਲਈ ਲੋਕੀਂ ਔਰ ਜਿਹੜੇ ਵੀ

ਜਿਹੜੇ ਖਿਲਾੜੀ ਜਿੱਤਦੇ ਹਨ ਉਹਨਾਂ ਨੂੰ ਕਈ ਤਰ੍ਹਾਂ ਦੇ ਪ੍ਰਾਈਜ਼ ਵੀ ਦਿੱਤੇ ਜਾਂਦੇ ਹਨ ਅਤੇ ਬਾਹਰਲੇ ਲੋਕ ਵੀ ਇਹਦੇ 'ਚ ਇੰਟਰਸਟ ਲੈਣ ਲੱਗ ਪਏ ਹਨ ਜਿਹਦੇ ਕਰਕੇ ਇਹਨਾਂ ਦੀ ਜਿਹੜੀ ਮਸ਼ਹੂਰੀ ਹੈ ਉਹ ਵੋ ਚੁੱਕੀ ਹੈ ਔਰ ਲੋਕ ਜੋ ਹੈ ਇਹਨਾਂ ਦੇ ਕੰਮਾਂ ਦੇ ਵਿੱਚ ਹਿੱਸਾ ਲੈ ਕੇ ਬਹੁਤ ਇੰਜੋਏ ਕਰਦੇ ਹਨ ਅਤੇ ਵੱਖ ਵੱਖ ਜਗ੍ਹਾ 'ਤੇ ਲੱਗਣ ਵਾਲੇ ਮੇਲਿਆਂ ਦਾ ਆਨੰਦ ਉਠਾਉਂਦੇ ਹਨ ਤਾਂ ਕਿ ਇਹ ਕੰਮ ਹੋਰ ਦਿਨ ਪ੍ਰਤੀ ਦਿਨ ਵੱਧਦਾ ਜਾਵੇ